ਹੈਲੋ ਸਤਿ ਸ਼੍ਰੀ ਅਕਾਲ ਬਾਈ ਮੈਂ ਝੁੰਬੇ ਪਿੰਡ ਤੋਂ ਬੋਲਦੀ ਹਾਂ ਅਮਨਪ੍ਰੀਤ ਕੌਰ ਵੀਰੇ ਮੈਂ ਦੋ ਪੈ ਦੋ ਘੰਟੇ ਪਹਿਲਾਂ ਹੀ ਇੱਕ ਨਾ ਕੈਬ ਬੁੱਕ ਕੀਤੀ ਸੀ ਅਤੇ ਤੁਸੀਂ ਮੈਨੂੰ ਉਹ ਕੈਬ ਦਾ ਦੋ ਦੋ ਘੰਟਿਆਂ ਦਾ ਟਾਈਮ ਦਿੱਤਾ ਸੀਗਾ ਤੁਸੀਂ ਕਿਹਾ ਸੀ ਕਿ ਮੈਂ ਦੋ ਘੰਟਿਆਂ ਵਿੱਚ ਤੁਹਾਡੇ ਕੋਲ ਪਹੁੰਚ ਜਾਵਾਂਗਾ ਅਤੇ ਵੀਰੇ ਮੈਨੂੰ ਡੇਢ ਘੰਟਾ ਹੋ ਗਿਆ ਇੱਥੇ ਖੜ੍ਹੀ ਨੂੰ ਪਰ ਤੁਸੀਂ ਮੈਨੂੰ ਪਹੁੰਚੇ ਨਹੀਂ ਹੈਗੇ ਇੱਥੇ ਬਹੁਤ ਹੀ ਜ਼ਿਆਦਾ ਭੀੜ ਆ ਅਤੇ ਬਹੁਤ ਜ਼ਿਆਦਾ ਗਰਮੀ ਆ ਅਤੇ ਪਾਣੀ ਵੀ ਪੀਣ ਵਾਲਾ ਇੱਥੇ ਹੈ ਨਹੀਂ ਹੈਗਾ ਕੋਈ ਵੀ ਪ੍ਰਬੰਧ ਹੈ ਨਹੀਂ ਹੈਗਾ ਅਤੇ ਮੈਨੂੰ ਪੂਰਾ ਇੱਥੇ ਡੇਢ ਘੰਟਾ ਹੋ ਗਿਆ ਖੜ੍ਹੀ ਨੂੰ ਅਤੇ ਤੁਸੀਂ ਹਾਲੇ ਤੱਕ ਆਏ ਨਹੀਂ ਅਤੇ ਤੁਸੀਂ ਮੈਨੂੰ ਦੋ ਘੰਟਿਆਂ ਦਾ ਹੀ ਟਾਈਮ ਦਿੱਤਾ ਸੀ ਤੁਸੀਂ ਕਿਹਾ ਸੀ ਮੈਂ ਸਹੀ ਦੋ ਘੰਟਿਆਂ 'ਚ ਤੁਹਾਡੇ ਕੋਲ ਪਹੁੰਚ ਜਾਊਗਾ ਤੁਸੀਂ ਮੈਨੂੰ ਦੱਸ ਦਿਓ ਕਿ ਕਿੰਨਾ ਕੁ ਟਾਈਮ ਲੱਗੇਗਾ ਕਿਉਂਕਿ ਮੇਰਾ ਅੱਜ ਨਾ ਇੱਕ ਪੇਪਰ ਹੈਗਾ ਅਤੇ ਉਹ ਦੇ 'ਚ ਵੀ ਸਿਰਫ ਮਤਲਬ ਕਿ ਅੱਧਾ ਕੁ ਘੰਟਾ ਹੀ ਰਹਿ ਗਿਆ ਸ਼ੁਰੂ ਹੋਣ 'ਚ ਅਤੇ ਜੇ ਮੈਂ ਉਹ ਪੇਪਰ ਦੇਣ ਲਈ ਉੱਥੇ ਨਾ ਪਹੁੰਚੀ ਤਾਂ ਮੈਨੂੰ ਫੇਲ ਕੀਤਾ ਜਾਊਗਾ ਕਿਉਂਕਿ ਮਤਲਬ ਕਿ ਉੱਥੇ ਜਾਣ 'ਤੇ ਵੀ ਪੱਚੀ ਵੀਹ ਮਿੰਟ ਤਾਂ ਪੂਰੇ ਲੱਗ ਹੀ ਜਾਣਗੇ ਇੱਥੋਂ ਅਤੇ ਤੁਸੀਂ ਅੱਧਾ ਘੰਟਾ ਹੀ ਰਹਿ ਗਿਆ ਹੈਗਾ ਅਤੇ ਤੁਸੀਂ ਮੈਨੂੰ ਦੋ ਘੰਟਿਆਂ ਦਾ ਟਾਈਮ ਦਿੱਤਾ ਸੀ ਦੋ ਘੰਟਿਆਂ 'ਚੋਂ ਡੇਢ ਘੰਟਾ ਤਾਂ ਵੀਰੇ ਟੱਪ ਹੀ ਗਿਆ ਅਤੇ ਪੱਚੀ ਮਿੰਟ 'ਚ ਮੈਂ ਉੱਥੇ ਵੀ ਪਹੁੰਚਣਾ ਹੈਗਾ ਅਤੇ ਉੱਥੇ ਗੇਟ ਵੀ ਬੰਦ ਹੋਜੂ ਅਤੇ ਜੇ ਮੈਂ ਪੇਪਰ 'ਚ ਨਾ ਪਹੁੰਚੀ ਤਾਂ ਮੈਨੂੰ ਉਹ ਫੇਲ ਕੀਤਾ ਜਾਊਗਾ ਤਾਂ ਕਰਕੇ ਪਲੀਜ਼ ਤੁਸੀਂ ਜਲਦੀ ਤੋਂ ਜਲਦੀ ਆ ਸਕਦੇ ਹੋ ਤਾਂ ਦੱਸਦੋ ਕਿਉਂਕਿ ਇੱਥੇ ਹੋਰ ਕੋਈ ਵੀ ਸਾਧਨ ਹੈ ਨਹੀਂ ਹੈਗਾ ਜੋ ਮੈਂ ਕਰਾਲਾਂ ਅਤੇ ਚੱਲੀ ਜਾਵਾਂ ਪਲੀਜ਼ ਵੀਰੇ ਜਲਦੀ ਤੋਂ ਜਲਦੀ ਆ ਜਾਓ ਥੈਂਕ ਯੂ ਬਾਈ